ਮੈਂ ਦਿਕਸ਼ਾ ਵਾਸੀ ਗੁਰਦਾਸਪੁਰ ਜ਼ਿਲ੍ਹੇ ਦੀ ਰਹਿਣ ਵਾਲੀ ਹਾਂ ਅਤੇ ਇਹ ਦੱਸਣਾ ਚਾਹੁੰਦੀ ਹਾਂ ਕਿ ਅੱਜ ਦੇ ਸਮੇਂ ਵਿੱਚ ਸਿੱਖਿਆ ਸੈਕਟਰ ਵਿੱਚ ਬਹੁਤ ਹੀ ਨਵੀਨਤਾ ਆਈ ਹੈ ਅੱਜ ਦਾ ਸਮਾਂ ਬਹੁਤ ਬਦਲ ਗਿਆ ਹੈ ਬੱਚਿਆਂ ਨੂੰ ਆਪਣੇ ਸਿੱਖਿਆ ਲਈ ਵੱਖ ਵੱਖ ਸਬਜੈਕਟ ਜਿਹੜੇ ਹੈ ਉਹ ਚੁਣਨੇ ਪੈਂਦੇ ਹੈ ਜਿਵੇਂ ਕਿ ਕੁਝ ਬੱਚੇ ਸਾਇੰਸ ਪੜ੍ਹਦੇ ਹਨ ਕੁਝ ਗਣਿਤ ਪੜ੍ਹਦੇ ਹਨ ਕੁਝ ਬੱਚੇ ਜੋ ਹੈ ਇਕਨੋਮਿਕਸ ਪੜ੍ਹਦੇ ਹਨ ਇਹ ਸਾਰੇ ਜੋ ਬੱਚੇ ਪੜ੍ਹਦੇ ਹਨ ਇਹ ਹੀ ਸਾਡਾ ਉਦਯੋਗ ਜਾਂ ਸੈਕਟਰ ਹਨ ਜੋ ਕਿ ਨਵੀਨਤਾ ਅਤੇ ਆਰਥਿਕ ਵਿਕਾਸ ਨੂੰ ਚਲਾ ਰਹੇ ਹਨ ਜਿਵੇਂ ਇਸ਼ਾਰਾ ਇੱਧਰ ਹੈ ਕਿ ਬੱਚੇ ਆਈ ਟੀ ਆਈ ਕਰਦੇ ਹਨ ਉਹਨਾਂ ਵਿੱਚ ਕੁਝ ਬੱਚੇ ਕੰਪਿਊਟਰ ਕੋਰਸ ਸਿੱਖਦੇ ਹਨ ਕੁਝ ਬੱਚੇ ਪਲੰਬਰਾਂ ਦਾ ਸਿੱਖਦੇ ਹਨ ਜਾਂ ਕੁਝ ਫਿਟਰ ਜਾ ਕੇ ਸਿੱਖਦੇ ਹਨ ਅਤੇ ਜਿਹੜੇ ਬੱਚੇ ਸਾਡੇ ਹੋਣਹਾਰ ਹੁੰਦੇ ਹਨ ਉਹ ਬੱਚੇ ਆਈ ਆਈ ਟੀ ਵਿੱਚ ਪੜ੍ਹਦੇ ਹਨ ਜਾਂ ਫਿਰ ਐਮ ਬੀ ਬੀ ਐੱਸ ਦੀ ਡਿਗਰੀ ਪ੍ਰਾਪਤ ਕਰਦੇ ਹਨ ਇਹਨਾਂ ਵਿੱਚੋਂ ਉਹ ਬੱਚੇ ਹੀ ਅੱਗੇ ਜਾ ਕੇ ਟੈਕਨੋਲੋਜੀ ਨੂੰ ਚੰਗਾ ਇੱਕ ਰੰਗ ਦਿੰਦੇ ਹਨ ਅਤੇ ਸਾਡੇ ਹੋਣਹਾਰ ਬੱਚੇ ਜਿਹੜੇ ਹੈ ਉਹ ਬਹੁਤ ਹੀ ਤਰੱਕੀ ਕਰਕੇ ਆਰਥਿਕ ਵਿਕਾਸ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਨ ਜਿਵੇਂ ਕਿ ਆਈ ਆਈ ਟੀ ਵਿੱਚ ਕੁਝ ਬੱਚੇ ਐਮ ਐਸ ਐਮ ਐਸ ਸੀ ਐਮ ਸੀ ਏ ਐਮ ਐਸ ਡਬਲਿਊ ਇਸ ਤਰ੍ਹਾਂ ਦੇ ਕੋਰਸ ਕਰਕੇ ਅੱਗੇ ਸਾਡੇ ਸਮਾਜ ਨੂੰ ਨਵੀਨਤਾ ਅਤੇ ਆਰਥਿਕ ਵਿਕਾਸ ਦੇ ਨਾਲ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਨ ਧੰਨਵਾਦ